ਹਾਂ ਮੈਨੂੰ ਪੰਜ ਅਜਿਹੀਆਂ ਤਰੀਕਾਂ ਯਾਦ ਹਨ ਜੋ ਕਿ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀਆਂ ਹਨ ਜਿਵੇਂ ਕਿ ਛੱਬੀ ਜਨਵਰੀ ਪੰਦਰ੍ਹਾਂ ਅਗਸਤ ਦੋ ਅਕਤੂਬਰ ਤੇਰ੍ਹਾਂ ਜਨਵਰੀ ਅਤੇ ਚੌਦ੍ਹਾਂ ਅਪ੍ਰੈਲ